ਅਸੀਂ ਆਪਣੇ ਕੱਪੜੇ ਮਤਲਬ ਜਿਵੇਂ ਅਲੱਗ ਅਲੱਗ ਤਰ੍ਹਾਂ ਦੇ ਕੱਪੜੇ ਹੁੰਦੇ ਆ ਆਪਣੇ ਜਿਵੇਂ ਕੋਈ ਕ ਵਾਈਟ ਹੁੰਦੇ ਆ ਕੋਈ ਕਲਰਫੁਲ ਹੁੰਦੇ ਹੈ ਮਤਲਬ ਉਹਨਾਂ ਨੂੰ ਅਲੱਗ ਅਲੱਗ ਤਰ੍ਹਾਂ ਧੋ ਸਕਦੇ ਹਾਂ ਆਪਾਂ ਵੀ ਜਿਵੇਂ ਵਾਈਟ ਕੱਪੜੇ ਹੁੰਦੇ ਆ ਉਹਨਾਂ ਨੂੰ ਆਪਾਂ ਇਕੱਲੇ ਧੋ ਸਕਦੇ ਹਾਂ ਉਹਨਾਂ ਵਿੱਚ ਮਤਲਬ ਜੇ ਆਪਾਂ ਰੰਗਦਾਰ ਕਪੜਿਆਂ ਵਿੱਚ ਪਾ ਦਿੱਤਾ ਕਲਰਫੁੱਲ ਵਾਲੇ 'ਚ ਪਾ ਦਿੱਤਾ ਫਿਰ ਉਹਨਾਂ ਵਿੱਚ ਉਹਨਾਂ 'ਤੇ ਕਲਰ ਚੜ੍ਹ ਜਾਉ ਵਾਈਟ ਕੱਪੜਿਆਂ 'ਤੇ ਇਸ ਕਰਕੇ ਵੀ ਜਿਹੜੇ ਵਾਈਟ ਕੱਪੜੇ ਉਹ ਅਲੱਗ ਅਲੱਗ ਤੋਂ ਧੋਣੇ ਚਾਹੀਦੇ ਹੈ ਅਤੇ ਜਿਹੜੇ ਕਲਰਫੁੱਲ ਕੱਪੜੇ ਹੁੰਦੇ ਉਹ ਅਲੱਗ ਧੋਣੇ ਚਾਹੀਦੇ ਜਿਵੇਂ ਕੋਈ ਸਾਡੇ ਕੱਪੜੇ ਹੁੰਦੇ ਆ ਜਿਵੇਂ ਗਰਮ ਕੱਪੜੇ ਹੁੰਦੇ ਆ ਸਾਡੇ ਗਰਮ ਕੱਪੜੇ ਹੁੰਦੇ ਆ ਅਤੇ ਕੋਈ ਪਤਲੇ ਕੱਪੜੇ ਹੁੰਦੇ ਜਿਵੇਂ ਗਰਮ ਕਪੜਿਆਂ 'ਤੇ ਜਿਹੜੀ ਬੁਰ ਆ ਜਾਂਦੀ ਆ ਜਿਵੇਂ ਬੁਰ ਤੋਂ ਬਚਾਉਣ ਲਈ ਉਹਨਾਂ ਨੂੰ ਅਸੀਂ ਜਿਵੇਂ ਈਜੀ ਨਾਲ ਧੋ ਸਕਦੇ ਹਾਂ ਈਜੀ ਨਾਲ ਅਲੱਗ ਜਿਵੇਂ ਆਪਾਂ ਪਹਿਲਾਂ ਹੁੰਦਾ ਸੀਗਾ ਪਹਿਲਾਂ ਜ਼ਿਆਦਾ ਦਿੱਕਤ ਆਉਂਦੀ ਹੁੰਦੀ ਸੀਗੀ ਜਿਵੇਂ ਪਹਿਲੀ ਸਮਿਆਂ ਵਿੱਚ ਮਸ਼ੀਨ ਨਹੀਂ ਹੁੰਦੀ ਸੀ ਕੁਛ ਨਹੀਂ ਹੁੰਦਾ ਸੀ ਕੋਈ ਮਤਲਬ ਫੈਸਿਲਿਟੀ ਨਹੀਂ ਸੀਗੀ ਹੁਣ ਮਤਲਬ ਸਾਰੀਆਂ ਫੈਸਿਲਿਟੀਆਂ ਹੈਗੀਆਂ ਅਸੀਂ ਮਤਲਵ ਪਹਿਲਾਂ ਜਿਵੇਂ ਪਹਿਲਾਂ ਫੈਸੀਲਿਟੀ ਨਾ ਹੋਣ ਕਰਕੇ ਲੋਕ ਵਿਚਾਰੇ ਮਸਾਂ ਕੱਪੜੇ ਧੋਂਦੇ ਸੀਗੇ ਦੋ ਦੋ ਤਿੰਨ ਤਿੰਨ ਦਿਨ ਉਹ ਹੀ ਕੱਪੜੇ ਪਾਈ ਰੱਖਦੇ ਸੀਗੇ ਦੋ ਤਿੰਨ ਦਿਨਾਂ ਬਾਅਦ ਧੋਂਦੇ ਸੀ ਜਿਵੇਂ ਸਰਦੀ ਵਿੱਚ ਉਹਨਾਂ ਨੂੰ ਬਹੁਤ ਔਖਾ ਹੁੰਦਾ ਹੁੰਦਾ ਸੀਗਾ ਵੀ ਉਹਨਾਂ ਨੂੰ ਸੁਕਾਉਣ ਉਹ ਦਾ ਬਹੁਤ ਦਿੱਕਤ ਆਉਂਦੀ ਸੀ ਕੱਪੜੇ ਇਸ ਲਈ ਤਿੰਨ ਤਿੰਨ ਚਾਰ ਚਾਰ ਦਿਨ ਉਹ ਹੀ ਕੱਪੜੇ ਪਾਉਂਦੇ ਸੀਗੇ ਅਤੇ ਹੁਣ ਤਾਂ ਫੈਸਿਲਟੀ ਬਹੁਤ ਜ਼ਿਆਦਾ ਵਧ ਗਈ ਹੈ ਅਸੀਂ ਆਪਣੀ ਮਸ਼ੀਨ ਵਿੱਚ ਅ ਆਪਣੀ ਵੋਸ਼ਿੰਗ ਵਿੱਚ ਕੱਪੜੇ ਵਧੀਆ ਤਰ੍ਹਾਂ ਨਾਲ ਜਲਦੀ ਧੋ ਸਕਦੇ ਹਾਂ ਅਤੇ ਅ ਅਸੀਂ ਜਦੋਂ ਆਪਣੀ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਧੋਂਦੇ ਆ ਤਾਂ ਵਧੀਆ ਪਾਊਡਰ ਪਾਉਣਾ ਚਾਹੀਦਾ ਜਿਸ ਕਰਕੇ ਕਿ ਕੱਪੜੇ ਵਧੀਆ ਰਹਿ ਸਕਣ ਉਹਨਾਂ ਦਾ ਕਲਰ ਵਧੀਆ ਬਰਕਰਾਰ ਰਹਿ ਸਕੇ ਉਹਨਾਂ ਵਿੱਚ ਬੁਰ ਵੀ ਨਾ ਆਵੇ ਅਤੇ ਜੇ ਜਿਹੜੇ ਦੂਜੀ ਕੋਈ ਖ਼ਾਸ ਕੱਪੜੇ ਹੁੰਦੇ ਆ ਜਿਵੇਂ ਮਤਲਵ ਵਿਆਹ ਵਾਸਤੇ ਪਾਉਣ ਵਾਸਤੇ ਜਿਵੇਂ ਮੈਰਿਜ 'ਤੇ ਪਾਉਂਦੇ ਉਹਨਾਂ ਨੂੰ ਅਸੀਂ ਆਪਣੇ ਹੱਥ ਨਾਲ ਧੋ ਸਕਦੇ ਹਾਂ ਹੱਥ ਨਾਲ ਧੋ ਸਕਦੇ ਆ ਕਿਉਂਕਿ ਉਹ ਮਸ਼ੀਨ ਵਿੱਚ ਖ਼ਰਾਬ ਹੋ ਜਾਂਦੇ ਆ ਜਿਵੇਂ ਅਸੀਂ ਪਹਿਲਾਂ ਜਿਵੇਂ ਹੁਣ ਸਕਾਉਣ ਦੀ ਗੱਲ ਕਰਦੇ ਆਂ ਜਿਵੇਂ ਪਹਿਲਾਂ ਸਮਿਆਂ ਵਿੱਚ ਮਸ਼ੀਨਾਂ ਜਾਂ ਫੈਸਲਿਟੀ ਨਾ ਹੋਣ ਕਰਕੇ ਹੁਣ ਵਾਲੀ ਫੈਸਿਲਿਟੀ ਨਾ ਹੋਣ ਕਰਕੇ ਉਹਨਾਂ ਨੂੰ ਦਿੱਕਤ ਆਉਂਦੀ ਸੀ ਸਕਾਉਣ ਵਾਰੇ ਪਰ ਹੁਣ ਅਸੀਂ ਮਸ਼ੀਨ ਵਿੱਚ ਦਸ ਮਿੰਟ ਪੰਜ ਮਿੰਟ ਵਿੱਚ ਸਕਾ ਸਕਦੇ ਹਾਂ ਪੁਰਾਣੇ ਸਮਿਆਂ ਵਿੱਚ ਉਹਨੂੰ ਸੁਕਾਉਣ ਵਿੱਚ ਵੀ ਡਿਕ ਕ ਦਿੱਕਤ ਆਉਂਦੀ ਸੀਗੀ ਵਿਚਾਰੇ ਨੂੰ ਸਾਂ ਕਦੇ ਮੀਂਹ ਆ ਜਾਂਦਾ ਸੀਗਾ ਕਦੇ ਕਿਵੇਂ ਅੰਦਰ ਪਾਉਂਦੇ ਸੀਗੇ ਅਤੇ ਪਰ ਹੁਣ ਵੀ ਮੀਂਹ ਆ ਜਾਵੇ ਤਾਂ ਅੰਦਰ ਹੀ ਪਾਉਣੇ ਪੈਂਦੇ ਆ ਤਾਂ ਪਰ ਅਸੀਂ ਸ ਹੁਣ ਵਧੀਆ ਢੰਗ ਨਾਲ ਸੁਕਾ ਸਕਦੇ ਆ ਮਸ਼ੀਨ ਵਿੱਚ ਸੁਕਾ ਸਕਦੇ ਧੁੱਪ ਵਿੱਚ ਸੁਕਾ ਸਕਦੇ ਹੈ ਅਤੇ ਅਲੱਗ ਅਲੱਗ ਢੰਗਾਂ ਨਾਲ ਅਸੀਂ ਸੁਕਾ ਸਕਦੇ ਹਾਂ ਜਿਵੇਂ ਕਈ ਵਾਰ ਧੁੱਪ ਨਾ ਹੋਵੇ ਤਾਂ ਅਸੀਂ ਛੱਤ 'ਤੇ ਸੁਕਾ ਸਕਦੇ ਹੋ ਕੱਪੜੇ